ਚਾਰ ਜੁਲਾਈ ਉੱਨੀ ਸੌ ਚੁਰਾਸੀ ਸੋਲ੍ਹਾਂ ਜਨਵਰੀ ਉੱਨੀ ਸੌ ਬਾਹਠ ਤੀਹ ਨਵੰਬਰ ਉੱਨੀ ਸੌ ਅਠਾਸੀ ਬਾਰ੍ਹਾਂ ਮਾਰਚ ਉੱਨੀ ਸੌ ਛਿਆਸੀ ਬਾਈ ਜੂਨ ਉੱਨੀ ਸੌ ਨੜਿਨਵੇਂ